ਸਿੱਖਿਅਤ ਹੋਣ ਨਾਲ਼ ਬੰਦਾ ਆਪਣੀ ਜ਼ਿੰਦਗੀ ਬਹੁਤ ਵਧੀਆ ਤਰੀਕੇ ਨਾਲ਼ ਗੁਜ਼ਾਰ ਸਕਦਾ ਹੈ ਕੁੜੀਆਂ ਨੂੰ ਤਾਂ ਬਹੁਤ ਵਧੀਆ ਗੱਲ ਹੈ ਸਿੱਖਿਅਤ ਹੋਣਾ ਕਿਉਂਕਿ ਸਾਨੂੰ ਕਿਸੇ ਦੇ ਉੱਪਰ ਹਾਵੀ ਨਹੀਂ ਹੋਣਾ ਪੈਂਦਾ ਸਾਨੂੰ ਕਿਸੇ ਦੇ ਉੱਪਰ ਡਿਪੈਂਡ ਨਹੀਂ ਹੋਣਾ ਪੈਂਦਾ ਅਸੀਂ ਆਪਣੇ ਮਿਹਨਤ ਨਾਲ ਕਮਾ ਕੇ ਖਾ ਸਕਦੇ ਹਾਂ ਅਸੀਂ ਆਪਣੇ ਪਰਿਵਾਰ ਦਾ ਵੀ ਪੇਟ ਪਾਲ਼ ਸਕਦੇ ਹਾਂ ਅਨਪੜ੍ਹ ਲੋਕਾਂ ਨੂੰ ਵੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਨਪੜ੍ਹ ਲੋਕ ਆਪਣੇ ਬੱਚਿਆਂ ਨੂੰ ਪੜ੍ਹਾ ਨਹੀਂ ਸਕਦੇ ਉਹਨਾਂ ਨੂੰ ਪੜ੍ਹਾਉਣ ਲਈ ਟਿਊਸ਼ਨ ਰਖਾਉਣੀਆਂ ਪੈਂਦੀ ਆਪਣੇ ਬੱਚਿਆਂ ਨੂੰ ਟਿਊਸ਼ਨਾਂ ਦੇ ਵਿੱਚ ਵੀ ਉਹਨਾਂ ਨੂੰ ਲੋਕਾਂ ਨੂੰ ਫੀਸਾਂ ਦੇਣੀਆਂ ਪੈਂਦੀਆਂ ਹਨ ਹੋਰ ਵੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਨਪੜ੍ਹ ਲੋਕਾਂ ਨੂੰ ਅਨਪੜ੍ਹ ਲੋਕਾਂ ਨੂੰ ਨੌਕਰੀ ਲਈ ਵੀ ਬਹੁਤ ਸਾਰੇ ਧੱਕੇ ਖਾਣੇ ਪੈਂਦੇ ਹਨ ਕਿਉਂਕਿ ਉਹਨਾਂ ਦੀ ਸਟੱਡੀ ਉਹਨਾਂ ਦੀ ਪੜ੍ਹਾਈ ਘੱਟ ਹੁੰਦੀ ਹੈ ਇਸ ਕਰਕੇ ਉਹਨਾਂ ਨੂੰ ਜਿਹੜੀ ਹੈ ਨੌਕਰੀ ਨਹੀਂ ਮਿਲਦੀ ਜੇਕਰ ਬੱਚਾ ਪੜ੍ਹਿਆ ਲਿਖਿਆ ਹੋਵੇਗਾ ਤਾਂ ਉਸਨੂੰ ਨੌਕਰੀ ਵੀ ਆਸਾਨੀ ਨਾਲ਼ ਮਿਲ ਜਾਂਦੀ ਹੈ